ਸਤਿ ਸ਼੍ਰੀ ਅਕਾਲ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਦੱਸੋ ਮੈਂ ਕੀ ਸੇਵਾ ਕਰ ਸਕਦੀ ਤੁਹਾਡੀ ਹਾਂਜੀ ਮੈਮ ਉਸ ਪਲੇਟ ਵਿੱਚ ਮਟਰ ਪਨੀਰ ਹੋਵੇਗਾ ਦਾਲ ਮੱਖਣੀ ਚਾਵਲ ਹੋ ਹੋਣਗੇ ਵਧੀਆ ਕੁਆਲਿਟੀ ਦੇ ਔਰ ਜੋ ਤੁਸੀਂ ਮਤਲਬ ਜੋ ਤੁਸੀਂ ਚਾਹੁੰਦੇ ਹੋ ਜੋ ਵੀ ਮਤਲਬ ਜੋ ਡਿਸ਼ਸ਼ ਤੁਹਾਨੂੰ ਚਾਹੀਦੀਆਂ ਉਹ ਸਭ ਅਵੇਲੇਬਲ ਹੋਣਗੀਆਂ ਔਰ ਸਭ ਦਾ ਅਲੱਗ ਅਲੱਗ ਹਰ ਪਲੇਟ ਦਾ ਅਲੱਗ ਅਲੱਗ ਰੇਟ ਹੈ ਹਾਂਜੀ ਹਾਂਜੀ ਅਲੱਗ ਤੋਂ ਪੈ ਸਕਦਾ ਫਿਰ ਉਹਦਾ ਰੇਟ ਵਧੇਗਾ ਅੱਠ ਸੌ ਦਾ ਹਜ਼ਾਰ ਤੱਕ ਬਾਰ੍ਹਾਂ ਸੌ ਤੱਕ ਦਾ ਉਹਦਾ ਰੇਟ ਹੋਵੇਗਾ ਮੈਮ ਨਹੀਂ ਇਹ ਤਾਂ ਤੁਹਾਨੂੰ ਸਭ ਜਾਇਜ਼ ਰੇਟ ਦੱਸਿਆ ਤੁਹਾਨੂੰ ਹਰ ਚੀਜ਼ ਤੁਹਾਨੂੰ ਵਧੀਆ ਵਧੀਆ ਮਿਲੇਗੀ ਹਾਂਜੀ ਬੋਲੋ ਮੈਮ ਹਾਂਜੀ ਹਾਂਜੀ ਮੈਮ ਠੀਕ ਹੈ ਮੈਮ ਜਿੱਦਾਂ ਤੁਸੀਂ ਕਹੋਗੇ ਤੁਹਾਨੂੰ ਉੱਦਾਂ ਦੀ ਚੀਜ਼ ਮਿਲੇਗੀ ਹਾਂਜੀ ਮੈਮ ਸਭ ਕੁਛ ਅਵੇਲੇਬਲ ਹੈ ਤੁਸੀਂ ਜਿੱਦਾਂ ਕਰਨਾ ਤੁਸੀਂ ਮੈਨੂੰ ਪਲੀਸ ਟਾਈਮ ਤੋਂ ਪਹਿਲਾਂ ਦੱਸ ਦਿਓ ਮੈਂ ਅਸੀਂ ਉੱਦਾਂ ਦਾ ਅਰੇਂਜ ਕਰਾਂਗੇ ਡੈਕੋਰੇਸ਼ਨ ਦਾ ਮੈਮ ਅਲੱਗ ਤੋਂ ਚਾਰਜਿਜ਼ ਲੱਗਣਗੇ ਡੈਕੋਰੇਸ਼ਨ ਵਧੀਆ ਤੋਂ ਵਧੀਆ ਹੋਵੇਗੀ ਜਿਸ ਜਿਸ ਤਰੀਕੇ ਦੀ ਤੁਸੀਂ ਡੈਕੋਰੇਸ਼ਨ ਕਰਵਾਉਣੀ ਆ ਤੁਸੀਂ ਸਾਨੂੰ ਦੱਸ ਦਿਓ ਤੁਸੀਂ ਸਾਡੇ ਇੱਥੇ ਆ ਕੇ ਦੇਖ ਸਕਦੇ ਹੋ ਕਿ ਅਸੀਂ ਕਿੱਦਾਂ ਦੀ ਡੈਕੋਰੇਸ਼ਨ ਕਰਦੇ ਹਾਂ ਹਾਂਜੀ ਮੈਮ ਜੀ ਠੀਕ ਹੈ ਮੈਮ ਥੈਂਕ ਯੂ ਓਕੇ ਮੈਮ ਜਦ ਮਰਜ਼ੀ ਤੁਸੀਂ ਕੋਲ ਕਰਕੇ ਪੁੱਛ ਸਕਦੇ ਹੋ